ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਦੱਸੋ ਹਾਂਜੀ ਮੈਡਮ ਸਪੋਟਸ ਮੀਟਸ ਹੋ ਰਹੀ ਹੈ ਆਪਣੇ ਨੈਕਸਟ ਵਕੇਸ਼ਨ ਤੋਂ ਬਾਅਦ ਹੋਣੀ ਹੈ ਛੁੱਟੀਆਂ ਤੋਂ ਬਾਅਦ ਅਤੇ ਦੇਖੋ ਅਸੀਂ ਨਾ ਟਰਾਇਲ ਲਏ ਸੀ ਸਟੂਡੈਂਟਸ ਨੇ ਜਿੱਦਾਂ ਗਰਾਊਂਡ ਦੇ ਵਿੱਚ ਨਾ ਕਿਉਂਕਿ ਆਪਾਂ ਹੁਣ ਇੱਦਾਂ ਅਤੇ ਗੇਮ ਸੇਮ ਜਿਹੜੇ ਹੁੰਦੀਆਂ ਨੇ ਹੈ ਨਾ ਅਤੇ ਆਪਾਂ ਟਰਾਇਲ ਲਏ ਸੀਗੇ ਅਤੇ ਆਪਾਂ ਟਰਾਇਲ ਲਏ ਸੀਗੇ ਅਤੇ ਟਰਾਇਲ ਦੇ ਵਿੱਚ ਜਿਹੜੇ ਬੱਚੇ ਸਲੈਕਟ ਹੋਏ ਨੇ ਉਹਨਾਂ ਨੂੰ ਹੀ ਆਪਾਂ ਗੇਮਸ ਦੇ ਵਿੱਚ ਲਿਆ ਆ ਉਸ ਦਿਨ ਫਿਰ ਉਹ ਬੱਚੇ ਗੇਮਸ ਪਲੇ ਕਰਨਗੇ ਪਹਿਲਾਂ ਟਰਾਇਲ ਆਪਾਂ ਸਾਰੀ ਕਲਾਸਿਸ ਦੇ ਲਏ ਆ ਸਾਰੇ ਬੱਚਿਆਂ ਦੇ ਹੀ ਟਰਾਇਲ ਲਏ ਆ ਔਰ ਟਰਾਇਲ ਕਿਹੜੇ ਬੱਚੇ ਫਸਟ ਸੈਕੰਡ ਥਰਡ ਫੋਰਥ ਇੱਦਾਂ ਆਏ ਨੇ ਉਹਨਾਂ ਨੂੰ ਆਪਾਂ ਸਲੈਕਟ ਕੀਤਾ ਆ ਫਾਈਨਲ ਦੇ ਦਿਆਂਗੇ ਦੇ ਲਈ ਦੇਖੋ ਅਸੀਂ ਮਤਲਬ ਕਰਵਾਇਆ ਸੀਗਾ ਅਤੇ ਇਹਨੂੰ ਪਰ ਇਹ ਕਰ ਨਹੀਂ ਪਾਇਆ ਆਈ ਥਿੰਕ ਗਰਾਊਂਡ ਦੇ ਵਿੱਚ ਰਨਿੰਗ ਕਰਵਾਈ ਸੀਗੀ ਬੱਚਿਆਂ ਤੋਂ ਹੋਰ ਐਕਟੀਵਿਟੀਜ਼ ਕਰਵਾਈਆਂ ਸੀਗੀਆਂ ਨਾ ਅਤੇ ਜਿੱਦਾਂ ਪੇਅਰ ਬਣਾਏ ਸੀ ਕਲਾਸ ਦੇ ਬੱਚਿਆਂ ਦੇ ਨਾਲ ਬੱਚਿਆਂ ਦੇ ਗਰਲਸ ਦੇ ਅਤੇ ਬੋਇਜ ਦੇ ਪੇਅਰਸ ਬਣਾਏ ਸੀਗੇ ਬਟ ਇਹ ਨਾ ਕਰਨ ਨਹੀਂ ਪਾਇਆ ਹੈ ਨਾ ਇਸ ਕਰਕੇ ਫਿਰ ਇਹਨਾਂ ਨਹੀਂ ਨਾਮ ਲਿਸਟ ਦੇ ਵਿੱਚ ਆਇਆ ਹੈਗਾ ਹਾਂਜੀ ਨਹੀਂ ਤੁਸੀਂ ਨੂੰ ਸਮਝਾਉਣਾ ਸੀ ਦੇਖੋ ਇੱਦਾਂ ਅਸੀਂ ਹੁਣ ਪਾਰਸ਼ੀਐਲਿਟੀ ਵੀ ਨਾ ਕਰ ਸਕਦੇ ਹੁਣ ਦੇਖੋ ਕਲਾਸ ਦੇ ਫੋਰ ਸਟੂਡੈਂਟਸ ਹੈਗੇ ਨੇ ਅਤੇ ਆਪਾਂ ਫਿਰ ਜੇ ਆਪਾਂ ਇੱਦਾਂ ਆਪਣੀ ਮਰਜ਼ੀ ਦੇ ਵਿੱਚ ਸਲੈਕਟ ਕਰਨ ਲੱਗੇ ਤਾਂ ਫਿਰ ਬਾਕੀ ਬੱਚੇ ਕਹਿਣਗੇ ਨਾ ਅਤੇ ਉਸ ਦਿਨ ਤੁਹਾਨੂੰ ਪਤਾ ਸਾਰੇ ਸਕੂਲ ਦਾ ਹੀ ਸਪੋਰਟਸ ਦੇ ਸਾਰੇ ਸਕੂਲ ਦਾ ਹੀ ਸਪੋਰਟਸ ਡੇ ਹੈ ਅਤੇ ਸਾਰੇ ਸਕੂਲ 'ਚ ਤੁਹਾਨੂੰ ਪਤਾ ਹੁਣ ਕਿੰਨੀਆਂ ਅਠਾਰਾਂ ਸੌ ਬੱਚਾ ਹੈ ਅਤੇ ਆਪਾਂ ਅਠਾਰਾਂ ਸੌ ਬੱਚੇ ਨੂੰ ਸਪੋਰਟਸ 'ਚ ਪਾਰਟੀਸੀਪੇਟ ਨਹੀਂ ਕਰਵਾ ਸਕਦੇ ਪੋਸੀਬਲ ਨਹੀਂ ਹੈਗਾ ਨਾ ਇਸ ਲਈ ਬੱਚੇ ਸਲੈਕਟ ਕਰਨੇ ਪੈਂਦੇ ਆ ਇਸ ਲਈ ਵੀ ਆਪਾਂ ਕਲਾਸ ਟਰਾਇਲ ਲੈਂਦੇ ਹਾਂ ਨਾ ਅਤੇ ਤੁਸੀਂ ਇਹਨੂੰ ਮੋਟੀਵੇਟ ਕਰੋ ਮੈਂ ਵੀ ਮੋਟੀਵੇਟ ਕਰੂੰਗੀ ਬਈ ਕੋਈ ਨਹੀਂ ਨੈਕਸਟ ਟਾਈਮ ਇਹ ਵਧੀਆ ਕਰਿਆ ਕਰੇ ਗੇਮਸ ਦੇ ਵਿੱਚ ਤਾਂ ਜੋ ਮਤਲਬ ਕਿ ਫਿਰ ਅਗਲੀ ਵਾਰ ਸਲੈਕਟ ਹੋ ਜਾਏਗਾ ਆਪਾਂ ਤਾਂ ਹਰ ਸਾਲ ਸਪੋਰਟ ਦੇ ਹੁੰਦਾ ਆ ਅਤੇ ਇਹਨੂੰ ਕਹੋ ਕਿ ਜਦੋਂ ਕਲਾਸ ਦੀਆਂ ਗੇਮਸ ਹੁੰਦੀਆਂ ਗੇਮ ਖੇਡ ਹੁੰਦਾ ਥੋੜ੍ਹਾ ਐਕਟਿਵਲੀ ਪਾਰਟੀਸੀਪੇਟ ਕਰਿਆ ਹੋਇਆ ਕਰੇ ਦੂਜੀ ਗੱਲਾਂ ਆ ਕਿ ਤੁਸੀਂ ਇਹਨੂੰ ਥੋੜ੍ਹੀ ਛੁੱਟੀਆਂ ਵੀ ਘੱਟ ਕਰਵਾਇਆ ਕਰੋ ਇਹ ਐਬਸੈਂਟ ਵੀ ਬਹੁਤ ਰਹਿੰਦਾ ਆ ਨਾ ਥੋੜ੍ਹਾ ਇੰਨਾ ਐਕਟਿਵ ਨਹੀਂ ਹੈਗਾ ਉਹ ਤਾ ਹੈ ਮੈਡਮ ਪਰ ਦੇਖੋ ਬੱਚਾ ਜੇ ਰੈਗੂਲਰ ਸਕੂਲ ਆਏਗਾ ਅਤੇ ਫਿਰ ਹੀ ਹੈ ਨਾ ਦੇਖੋ ਜਿੰਨੇ ਬੱਚੇ ਛੁੱਟੀਆਂ ਕਰਦਾ ਬੱਚੇ ਦਾ ਨੁਕਸਾਨ ਨਹੀਂ ਹੁੰਦਾ ਆ ਪੜ੍ਹਾਈ ਦੇ ਨਾਲ ਨਾਲ ਆਪਾਂ ਇਕੱਲੀ ਅਕੈਡਮਿਕ ਹੀ ਨਹੀਂ ਨਾ ਸਕੂਲ ਦੇ ਵਿੱਚ ਹੋਰ ਵੀ ਕਾਫੀ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਆ ਹੁਣ ਮੰਨ ਲਓ ਉਸ ਦਿਨ ਕੋਈ ਐਕਟਿਵ ਤੁਹਾਡਾ ਬੱਚਾ ਹੁੰਦਾ ਅਤੇ ਉਹਦੀ ਫਿਰ ਉਹ ਮਿਸ ਹੋ ਜਾਂਦੀ ਹੈ ਨਾ ਸੋ ਇਸ ਲਈ ਮਤਲਬ ਬੱਚਾ ਸਕੂਲ ਤੋਂ ਬਹੁਤ ਕੁਝ ਸਿੱਖਦਾ ਆ ਅਤੇ ਇਹ ਐਬਸੈਂਟ ਦੀ ਬਹੁਤ ਜ਼ਿਆਦਾ ਹੁੰਦਾ ਇਸੇ ਕਰਕੇ ਦੀਆਂ ਜਿਹੜੀਆਂ ਐਕਟੀਵਿਟੀਜ਼ ਆ ਉਹ ਪ੍ਰੋਪਰ ਹੋ ਨਹੀਂ ਆਉਂਦੀਆਂ ਨਾ ਨਹੀਂ ਪਰ ਤੁਸੀਂ ਇਹਨੂੰ ਐਕਟਿਵ ਬਣਾਓ ਨਾ ਤੁਸੀਂ ਉਹਨੂੰ ਖ਼ੁਦ ਲੇਜੀ ਬਣਾ ਰਹੇ ਆ ਅਤੇ ਤੁਸੀਂ ਇਹਨੂੰ ਐਕਟਿਵ ਕਰੋ ਅਤੇ ਤੁਸੀਂ ਉਹਨਾਂ ਨੂੰ ਮੋਟੀਵੇਟ ਕਰੋ ਅਤੇ ਕੋਈ ਗੱਲ ਨਹੀਂ ਕਿ ਤੂੰ ਵਧੀਆ ਜਿਹੜੀ ਕਲਾਸ ਦਾ ਗੇਮਸ ਮਤਲਬ ਵਧੀਆ ਪਰਫੋਰਮ ਕਰਿਆ ਕਰ ਅਤੇ ਫਿਰ ਆਪਾਂ ਤੁਹਾਨੂੰ ਅਗਲੀ ਵਾਰ ਜਿਹੜਾ ਮਤਲਬ ਕਿ ਤੂੰ ਵੀ ਸਲੈਕਟ ਹੋ ਜਾਏਗਾ ਸਪੋਰਟਸ ਦੇ ਵਿੱਚ ਅਤੇ ਇੱਦਾਂ ਦੀ ਤਾ ਕੋਈ ਗੱਲ ਨਹੀਂ ਹੈਗੀ ਔਰ ਹੋਰ ਵੀ ਆਪਾਂ ਸਪੋਰਟਸ ਦੇ ਐਕਟੀਵਿਟੀਜ ਜਿੱਦਾਂ ਕਰਵਾ ਰਹੇ ਆ ਜ਼ਰੂਰੀ ਨਹੀਂ ਕਿ ਬੱਚੇ ਜਿਹੜੇ ਮਤਲਬ ਉਸ ਵਿੱਚ ਕਰ ਰਹੇ ਆ ਉਹ ਸਪੋਰਟਸ ਵਿੱਚ ਨਹੀਂ ਕਰਨੀ ਇਹ ਹੋਰ ਐਕਟੀਵਿਟੀ ਪਰਫੋਰਮ ਕਰ ਸਕਦਾ ਓਕੇ ਜੀ ਓਕੇ ਜੀ ਥੈਂਕ ਯੂ